ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਪ੍ਰਸਿੱਧ ਮਨੋਰੰਜਨ ਗਤੀਵਿਧੀਆਂ ਵਿੱਚੋਂ ਅ ਸਾਡੇ ਪੰਜਾਬ ਵਿੱਚ ਵੰਡਰਲੈਂਡ ਬਹੁਤ ਸਾਰੇ ਪਰਿਵਾਰ ਪਰਿਵਾਰ ਵਾਲੇ ਜਾਂਦੇ ਹਨ ਆਪਣੇ ਬੱਚੇ ਆਪਣੇ ਮਾਤਾ ਪਿਤਾ ਦੇ ਨਾਲ ਜਾਂਦੇ ਹਨ ਅਤੇ ਫੈਮਲੀ ਪੂਰੀ ਜਾਂਦੀ ਹੈ ਅਤੇ ਸਕੂਲ ਵਾਲੇ ਵੀ ਵੰਡਰਲੈਂਡ ਦੀ ਟਰਿਪ ਰੱਖਦੇ ਹਨ ਕਿ ਬੱਚੇ ਆਪਣੇ ਫਰੈਂਡਸ ਦੇ ਨਾਲ ਜਾ ਸਕਣ ਅਤੇ ਬੱ ਬੱਚੇ ਆਪਣੇ ਸਕੂਲ ਦੇ ਨਾਲ ਹੀ ਵੰਡਰਲੈਂਡ ਜਾਂਦੇ ਹਨ ਅਤੇ ਇੱਥੇ ਭੂਤ ਬੰਗਲਾ ਉੱਥੇ ਬਹੁਤ ਸਾਰੇ ਲੋਕ ਜਾਂਦੇ ਹਨ ਅਤੇ ਸਾਇੰਸ ਸਿਟੀ ਜੋ ਕਿ ਬਣੀ ਹੋਈ ਹੈ ਅਤੇ ਉਸ ਦੇ ਵਿੱਚ ਸਾਇੰਸ ਵਾਲੇ ਸਟੂਡੈਂਟਸ ਪੜ੍ਹਨ ਵਾਲੇ ਬੱਚੇ ਵੀ ਜਾਂਦੇ ਹਨ ਉਹਦੇ ਵਿੱਚ ਅ ਸਾਇੰਸ ਬਾਰੇ ਬਹੁਤ ਜ਼ਿਆਦਾ ਨੋਲੇਜ ਦਿੱਤੀ ਜਾਂਦੀ ਹੈ ਅਤੇ ਉਸ ਦੇਖਣਾ ਸਾਨੂੰ ਕਿੰਨਾ ਸਾਇੰਸ ਸਾਰੇ ਪਤਾ ਲੱਗਦਾ ਅਤੇ ਆਪਣੇ ਵਰਲਡ ਬਾਰੇ ਪਤਾ ਲੱਗਦਾ ਸਾਇੰਸ ਸਿਟੀ ਵਿੱਚ ਜਾ ਕੇ ਅਤੇ ਇੱਦਾਂ ਦੀ ਮਤਲਬ ਕਿ ਜਗਾ ਵਿੱਚ ਜਾ ਕੇ ਅਤੇ ਸਾਨੂੰ ਬਹੁਤ ਚੀਜ਼ਾਂ ਬਾਰੇ ਨੌਲੇਜ ਮਿਲਦੀ ਹੈ ਅਤੇ ਜਿਸ ਤਰ੍ਹਾਂ ਸਾਡੇ ਇੱਥੇ ਸਵਿਮਿੰਗ ਪੂਲ ਵਗੈਰਾ ਉਹਦੇ ਵਿੱਚ ਵੀ ਬੱਚੇ ਉਹ ਉਹਨਾਂ ਵਿੱਚ ਵੀ ਬੱਚੇ ਜਾਂਦੇ ਹਨ ਸਵਿਮਿੰਗ ਪੂਲ 'ਤੇ ਅਤੇ ਉਹਦੇ ਵਿਚ ਵੀ ਬੱਚੇ ਕੁਛ ਬੱਚੇ ਸਵੀਮਿੰਗ ਵਗੈਰਾ ਸਿੱਖਦੇ ਹਨ ਅਤੇ ਇਹਨਾਂ ਦੀ ਸਵੀਮਿੰਗ ਦੀ ਮਤਲਬ ਕਿ ਰੇਸ ਅ ਗੇਮ ਵੀ ਹੁੰਦੀ ਹੈ ਅਤੇ ਆ ਜਿਹੜਾ ਇੱਥੇ ਜ਼ਿਆਦਾ ਵਧੀਆ ਸਵੀਮਿੰਗ ਕਰਦਾ ਹੈ ਤਾਂ ਉਸ ਨੂੰ ਪ੍ਰਾਈਸ ਵੀ ਦਿੰਦੇ ਆ ਉਹ ਉਹਦੇ ਵਿੱਚ ਵੀ ਮਨੋਰੰਜਨ ਹੁੰਦਾ ਹੈ ਅਤੇ ਅ ਲੋਕ ਕਿੰਨੇ ਸਾਰੇ ਆ ਕੇ ਅਤੇ ਦੇਖਦੇ ਹਨ ਕਿ ਕਿਹਦੇ ਬੱਚਾ ਕਿਹੜਾ ਬੱਚਾ ਜ਼ਿਆਦਾ ਸਵਿਮਿੰਗ ਵਿੱਚੋਂ ਸਵੀਮਿੰਗ ਵਧੀਆ ਕਰਦਾ ਅਤੇ ਕਿਹਨੂੰ ਫਸਟ ਪ੍ਰਾਈਜ਼ ਮਿਲਦਾ ਹੈ